ਹਾਂ ਮੈਂ ਚਿੱਤਰਕਾਰੀ ਦੀ ਕਲਾਸ ਲਗਾਈ ਹੋਈ ਆ ਉਸ ਵਿੱਚ ਮੈਂ ਵੱਖਰੀਆਂ ਵੱਖਰੀਆਂ ਡਰਾਇੰਗਸ ਬਣਾਉਣੀਆਂ ਸਿੱਖੀਆਂ ਵਾ ਜਿਹੜੀ ਮੇਰੀ ਟੀਚਰ ਹੈਗੀ ਸੀ ਉਹਨੇ ਮੈਨੂੰ ਮਤਲਬ ਬਿਲਕੁਲ ਦੱਸਿਆ ਕਿ ਕਿਵੇਂ ਲਾਈਨਾਂ ਮਾਰਨੀਆਂ ਵਾ ਕਿਵੇਂ ਘੁੰਮਾਉਣਾ ਵਾ ਕਿਵੇਂ ਕੁਝ ਬਣਾਉਣਾ ਵਾ ਮੇਰੀ ਟੀਚਰ ਨੇ ਇੱਕ ਵਾਰ ਮੈਨੂੰ ਡੋਰਾ ਬਣਾਉਣੀ ਸਿਖਾਈ ਸੀ ਐਂਡ ਮੈਨੂੰ ਉਹ ਆਉਂਦੀ ਨੀਗੀ ਸੀ ਬਣਾਉਣੀ ਮੇਰੀ ਟੀਚਰ ਨੇ ਦੱਸਿਆ ਕਿ ਪਹਿਲਾਂ ਇਹਦਾ ਜਿਹੜਾ ਮੂੰਹ ਆ ਉਹਨੂੰ ਗੋਲ ਕਰਨਾ ਵਾ ਫਿਰ ਉਹਨੂੰ ਮਤਲਬ ਬਣਾਉਣਾ ਵਾ ਇਸ ਤਰ੍ਹਾਂ ਅਤੇ ਇਸ ਤਰ੍ਹਾਂ ਉਹ ਮਤਲਬ ਜਿਹੜਾ ਮੇਰਾ ਅਨੁਭਵ ਸੀ ਉਹ ਇੰਨਾ ਵਧੀਆ ਸੀ ਮੈਂ ਦੱਸ ਨਹੀਂ ਸਕਦੀ ਮੈਂ ਪਹਿਲੀ ਵਾਰ ਕੁੱਝ ਇੱਦਾਂ ਦਾ ਬਣਾਇਆ ਸੀ ਜਿਹਨੂੰ ਮੈਂ ਐਕਸਪਲੇਨ ਨਹੀਂ ਕਰ ਸਕਦੀ